ਜੀ ਹਾਂ ਅਸੀਂ ਸੋਚਦੇ ਆਂ ਮੀਡੀਆ ਨੇ ਸਿੱਖਿਆ ਪ੍ਰਣਾਲੀ ਨੂੰ ਪੰਜਾਬੀ ਭਾਸ਼ਾ ਵਿੱਚ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਜਿੱਦਾਂ ਅਖਬਾਰ ਅਖਬਾਰਾਂ ਵਿੱਚ ਪੰਜਾਬੀ ਵਿੱਚ ਛਪਦੇ ਆ ਰਸਾਲੇ ਮੈਗਜ਼ੀਨ ਜਿਦਾਂ ਸੋਸ਼ਲ ਮੀਡੀਆ ਵਿੱਚ ਵੀ ਖਬਰਾਂ ਪੰਜਾਬੀ ਵਿੱਚ ਦਿਖਾਈਆਂ ਜਾਂਦੀਆਂ ਅੱਜ ਕੱਲ ਇੱਕ ਖਬਰ ਵੀ ਪੰਜਾਬੀ ਅਖਬਾਰ ਵਿੱਚ ਦਸਾਈ ਜਾਂਦੀ ਆ ਕੁਝ ਪੰਜਾਬੀ ਮੁੱਖ ਰੂਪ ਵਿੱਚ ਦਰਸਾਈ ਜਾਂਦੀ ਆ ਜਿਦਾਂ ਸੋਸ਼ਲ ਮੀਡੀਆ ਵਿੱਚ ਟੀਵੀ ਚੈਨਲਾ ਤੇ ਖਬਰਾਂ ਪੰਜਾਬੀ 'ਚ ਆਉਂਦੀਆਂ ਯੂਟਿਊਬ ਫੇਸਬੁੱਕ ਸਾਰੇ ਸਾਰੇ ਪਾਸੇ ਪੰਜਾਬੀ ਦਾ ਬੋਲਬਾਲਾ ਸਿੱਖਿਆ ਪ੍ਰਣਾਲੀ ਵਿੱਚ ਵੀ ਸਕੂਲ ਲੈਵਲ ਤੋ ਲੈ ਕੇ ਕਾਲਜਾ ਯੂਨੀਵਰਸਿਟੀਆਂ ਤੱਕ ਪੰਜਾਬੀ ਭਾਸ਼ਾ ਦਾ ਬੋਲਬਾਲਾ ਹੈ ਪੀਐਚਡੀ ਤੱਕ ਪੰਜਾਬੀ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਆ ਪੰਜਾਬੀ ਨੂੰ ਸਹੀ ਤਰੀਕੇ ਨਾਲ ਦਰਸੋਨ ਕਰਕੇ ਇਸ ਤੇ ਬਹੁਤ ਸਾਰੇ ਸਰੋਤ ਵੱਧ ਰਹੇ ਹਨ ਸਕੂਲ ਤੋਂ ਲੈ ਕੇ ਕਾਲਜਾਂ ਤੱਕ ਪੰਜਾਬੀ ਭਾਸ਼ਾ ਲਾਜਮੀ ਤੌਰ 'ਤੇ ਕੀਤੀ ਗਈ ਹੈ ਹਰ ਇੱਕ ਅੱਜ ਕੱਲ ਸਕੂਲ ਦਾ ਹਰਨਾਮ ਵੀ ਪੰਜਾਬੀ ਵਿੱਚ ਲਿਖਿਆ ਜਾਂਦਾ ਕੋਈ ਵੀ ਸਕੂਲ ਆ ਕੋਈ ਵੀ ਦੁਕਾਨ ਆ ਹਰ ਇੱਕ ਦਾ ਨਾਮ ਪੰਜਾਬੀ ਭਾਸ਼ਾ ਵਿੱਚ ਲਿਖਣਾ ਲਾਜ਼ਮੀ ਕਰ ਦਿੱਤਾ ਇਸ ਵਿੱਚ ਮੀਡੀਆ ਅਤੇ ਸਿੱਖਿਆ ਪਰਨਾਲੀ ਦਾ ਬਹੁਤ ਵੱਡਾ ਯੋਗਦਾਨ ਆ ਜੋ ਕਿ ਪ੍ਰੈਸ ਦੇ ਵਿੱਚ ਪੰਜਾਬੀ ਅਖਬਾਰ ਅੰਤਰਰਾਸ਼ਟਰੀ ਤੌਰ ਤੇ ਖਬਰਾਂ ਪੰਜਾਬੀ ਵਿੱਚ ਛਾਪੀਆਂ ਜਾਂਦੀਆਂ ਤਾਂ ਕਿ ਪੰਜਾਬੀ ਭਾਸ਼ਾ ਨੂੰ ਉੱਚਾ ਦਰਜਾ ਮਿਲੇ